ਹੈਲੋ ਕੀ ਹਾਲ ਆ ਮਾਨਵ ਵਧੀਆ ਵਧੀਆ ਕਿਵੇਂ ਯਾਦ ਕੀਤਾ ਅੱਜ ਹਾਂ ਮੈਂ ਗੱਲ ਮੈਂ ਵੀ ਇੱਕ ਗੱਲ ਕਰ ਰਿਹਾ ਸੀ ਆਪਣੇ ਨਾਲ ਦੇ ਮੁੰਡੇ ਨਾਲ ਇੱਕ ਮੈਂ ਕਿਹਾ ਵੀ ਅੱਗੇ ਫਿਊਚਰ ਕੁਛ ਲੱਗਦਾ ਨਹੀਂ ਪੜ੍ਹਾਈ ਦਾ ਆਪਣੀ ਦਾ ਇੰਨਾ ਜ਼ਿਆਦਾ ਹਮ ਹਮ ਮੈਨੂੰ ਤਾਂ ਉਹ ਕਹਿ ਰਿਹਾ ਸੀ ਕਹਿੰਦਾ ਤੁਸੀਂ ਕੋਚਿੰਗ ਇੰਸਟੀਟਿਊਟ ਖੋਲ੍ਹ ਦਿਉ ਕਹਿੰਦਾ ਜਿਹੜੇ ਪਲੱਸ ਟੂ ਤੋਂ ਬਾਅਦ ਬੱਚੇ ਆਉਂਦੇ ਆ ਨਾ ਕਹਿੰਦਾ ਉਹਨਾਂ ਨੂੰ ਕੋਚਿੰਗ ਦੇ ਦਿਆ ਕਰੋ ਕਹਿੰਦਾ ਨਾਲੇ ਤੁਸੀਂ ਉਹ ਪੜ੍ਹੇ ਹੋਏ ਆ ਪੜ੍ਹਾਈ ਹਾਂ ਹਾਂ ਜਾਂ ਜਾਂ ਪਬਲੀਕੇਸ਼ਨ ਦਾ ਕੰਮ ਵੀ ਹੈਗਾ ਇੱਕ ਪੜ੍ਹਾਈ ਨਾਲ ਰਿਲੇਟਿਡ ਹੀ ਆ ਉਹ ਵੀ ਸਾਰਾ ਹਾਂ ਟਿਊਸ਼ਨ ਵਾਲਾ ਵੀ ਵਧੀਆ ਹਾਂ ਹਾਂ ਬਾਕੀ ਮੇਰੇ ਇੱਕ ਦੋ ਦੋਸਤ ਵੀ ਹੈਗੇ ਜਿਨ੍ਹਾਂ ਕੋਲ ਐਕਸਪੀਰੀਅੰਸ ਹੈਗਾ ਥੋੜ੍ਹਾ ਜਿਹਾ ਕੋਚਿੰਗ ਦਾ ਉੱਦਾਂ ਦਾ ਤੋਂ ਵੀ ਆਪਾਂ ਹੈਲਪ ਲੈ ਸਕਦੇ ਇਹਦੇ ਬਾਰੇ ਹਾਂ ਹਾਂ ਅੱਛਾ ਅੱਛਾ ਜਗ੍ਹਾ ਆਪਾਂ ਨੂੰ ਕਿਹੜੀ ਜਗ੍ਹਾ ਮਿਲੂ ਫਿਰ ਅੱਛਾ ਇੱਧਰ ਹੈਗੀਆ ਨੇ ਥਾਵਾਂ ਇੱਦਾਂ ਦੀਆਂ ਹਾਂ ਹਾਂ ਅੱਛਾ ਤੂੰ ਐਂ ਕਰੀ ਪਹਿਲਾਂ ਨਾ ਉੱਥੋਂ ਕਿਰਾਇਆ ਪਤਾ ਕਰੀ ਕਿੰਨਾ ਲੈਣਗੇ ਉਹ ਜੇ ਆਪਾਂ ਇੰਸਟੀਟਿਊਟ ਬਣਾਉਣਾ ਹੋਵੇ ਨਾ ਕਿਤੇ ਕਿਸੇ ਥਾਂ ਦੇਖ ਕੇ ਹਾਂ ਹਾਂ ਹਾਂ ਹਾਂ ਹਾਂ ਘਰ ਘਰ ਸਾਰੇ ਵਧੀਆ ਨੇ ਬਸ ਕੋਈ ਨਹੀਂ ਮੈਂ ਤੈਨੂੰ ਮੈਂ ਆਉਂਦਾ ਸ਼ਾਮੀ ਤੇਰੇ ਵੱਲ ਇੱਧਰ ਨੂੰ ਖਾਲਸਾ ਕਾਲਜ ਵੱਲ ਅਤੇ ਫਿਰ ਆਪਾਂ ਬਹਿ ਕੇ ਗੱਲ ਕਰਦੇ ਹਾਂ ਸਾਰੀ ਇਹਦੇ ਬਾਰੇ ਅਤੇ ਨਾਲੇ ਆਪਾਂ ਥਾਂ ਪਤਾ ਕਰ ਆਉਂਦੇ ਕਿੱਥੇ ਆਪਾਂ ਇੰਸਟੀਟਿਊਟ ਵਗੈਰਾ ਸਾਰਾ ਖੋਲ੍ਹਣ ਦੀ ਹੈ ਨਾ ਅਤੇ ਹਾਂ ਹਾਂ ਠੀਕ ਆ ਠੀਕ ਆ ਚੱਲ ਮੈਂ ਸ਼ਾਮੀ ਮਿਲਦਾ ਤੈਨੂੰ ਫਿਰ ਠੀਕ ਆ ਠੀਕ ਆ ਓਕੇ ਓਕੇ